ਸਤਿ ਸ਼੍ਰੀ ਅਕਾਲ ਮੈਮ ਹਾਂਜੀ ਮੈਮ ਤੁਸੀਂ ਕੌਣ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਮੈਮ ਤੁਸੀਂ ਡੋਮੈਸਟਿਕ ਵੋਏਲੈਂਸ ਦਾ ਕੇਸ ਫਾਈਲ ਕਰ ਸਕਦੇ ਹੋ ਉਹਨਾਂ ਦੇ ਉੱਤੇ ਅਤੇ ਤੁਸੀਂ ਕੰਮਪਲੇਟ ਵੀ ਕਰ ਸਕਦੇ ਹੋ ਉਹਨਾਂ ਦੀ ਪੁਲਿਸ ਸਟੇਸ਼ਨ ਦੇ ਵਿੱਚ ਤੁਸੀਂ ਮੇਰੇ ਚੈਂਬਰ ਆ ਜਿਓ ਕੱਲ੍ਹ ਨੂੰ ਅਤੇ ਆਪਾਂ ਬੈਠ ਕੇ ਡਿਸਕਸ ਕਰ ਲਵਾਂਗੇ ਸਾਰੀ ਗੱਲ ਓਕੇ ਮੈਮ ਤੁਸੀਂ ਕੀ ਕੰਮ ਕਰਦੇ ਹੋ ਠੀਕ ਹੈ ਮੈਮ ਫਿਰ ਤਾਂ ਤੁਸੀਂ ਟੈਨਸ਼ਨ ਨਾ ਲਉ ਤੁਸੀਂ ਤਾਂ ਫਰੀ ਲੀਗਲ ਏਡ ਦੇ ਅੰਡਰ ਹੀ ਕਵਰ ਹੋ ਜਾਣਾ ਆ ਡਿਸਟਿਕ ਦੇ ਵਿੱਚ ਨਾ ਲੀਗਲ ਏਡ ਹੁੰਦੀ ਹੈ ਜਿਹੜੇ ਕਿ ਇੰਕਨੋਮੀਕਲ ਵੀਕਰ ਸੈਕਸ਼ਨ ਹੁੰਦੇ ਆ ਨਾ ਉਹਨਾਂ ਨੂੰ ਮਿਲਦੀ ਹੈ ਅਤੇ ਤੁਸੀਂ ਉਹਦੇ ਅੰਡਰ ਕਵਰ ਹੋ ਜਾਣਾ ਫੀਸ ਤੁਸੀਂ ਬਿਲਕੁਲ ਟੈਨਸ਼ਨ ਨਾ ਲਉ ਹਾਂਜੀ ਹਾਂਜੀ ਮੈਮ ਤੁਸੀਂ ਕੱਲ੍ਹ ਨੂੰ ਮੇਰੇ ਚੈਂਬਰ ਆਓ ਅਸੀਂ ਕੱਲ੍ਹ ਦੇ ਕੱਲ੍ਹ ਕੇਸ ਫਾਈਲ ਕਰ ਦੇਵਾਂਗੇ ਅਤੇ ਨੈਕਸਟ ਵੀਕ ਤੱਕ ਪ੍ਰਸੀਡਿੰਗ ਵਗੈਰਾ ਸ਼ੁਰੂ ਵੀ ਹੋ ਜਾਣਗੀਆਂ ਤੁਸੀਂ ਬਿਲਕੁਲ ਟੈਨਸ਼ਨ ਨਾ ਲਓ ਹਾਂਜੀ ਹਾਂਜੀ ਮੈਮ ਡੋਮੈਸਟਿਕ ਵੋਏਲੈਂਸ ਐਕਟ ਦੇ ਅੰਡਰ ਜਿਹੜਾ ਤੁਹਾਡੇ ਹਸਬੈਂਡ ਹੈ ਉਹਨਾਂ ਦੇ ਅਗੇਨਜ਼਼ਟ ਕੇਸ ਫਾਈਲ ਹੋ ਜਾਵੇਗਾ ਅਤੇ ਇੱਕ ਐਫ ਆਈ ਆਰ ਜਿਹੜੀ ਹੈ ਉਹਨਾਂ ਦੇ ਅਗੇਨਜ਼ਟ ਕਰਵਾਉਣੀ ਪਵੇਗੀ ਕੋਈ ਨਹੀਂ ਮੈਮ ਉਹਨਾਂ ਦੀ ਕਸਟੀਡੀ ਤਾਂ ਤੁਹਾਡੇ ਕੋਲ ਹੀ ਰਹੇਗੀ

ਨਹੀਂ ਨਹੀਂ ਬੱਚੇ 'ਤੇ ਕੋਈ ਈਫੈਕਟ ਨਹੀਂ ਪਊਗਾ ਤੁਸੀਂ ਬਿਲਕੁਲ ਟੈਨਸ਼ਨ ਨਾ ਲਓ ਤੁਸੀਂ ਕੱਲ੍ਹ ਚੈਂਬਰ ਆ ਜਾਇਉ ਆਪਾਂ ਬੈਠ ਕੇ ਸਾਰੀ ਗੱਲ ਕਰ ਲਵਾਂਗੇ ਮੈਮ ਹੈਂਜੀ ਮੈਮ ਠੀਕ ਹੈ